ਸਤਿ ਸ਼੍ਰੀ ਅਕਾਲ ਸਰ ਮੈਂ ਗਗਨਪ੍ਰੀਤ ਕੌਰ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਜਿਵੇਂ ਕਿ ਕੁੜੀਆਂ ਅਤੇ ਮੁੰਡਿਆਂ ਦੀ ਖੇਡਾਂ ਦੀ ਗੱਲ ਕੀਤੀ ਗਈ ਹੈ ਅਤੇ ਕੁੜੀਆਂ ਕੁੜੀਆਂ ਜਿਵੇਂ ਕਿ ਛੋਟੇ ਹੁੰਦੇ ਆਪਣੇ ਬਰਤਨਾਂ ਜਿੱਦਾਂ ਨਕਲੀ ਭਾਂਡੇ ਹੁੰਦੇ ਆ ਉਹਨਾਂ ਦੇ ਨਾਲ ਖੇਡਦੀਆਂ ਹਨ ਅਤੇ ਬਟ ਜੋ ਮੁੰਡੇ ਹਨ ਉਹਨਾਂ ਨੂੰ ਭਾਂਡਿਆ ਮਤਲਬ ਕਿ ਭਾਂਡਿਆਂ ਵਿੱਚ ਕੋਈ ਇੰਟਰਸਟ ਨਹੀਂ ਹੁੰਦਾ ਅਤੇ ਉਹ ਭਾਂਡਿਆਂ ਦੇ ਨਾਲ ਨਹੀਂ ਖੇਡਦੇ ਉਹ ਲੂਡੋ ਕੈਰਮ ਬੋਰਡ ਅਤੇ ਜਿਵੇਂ ਕਿ ਲੁਡੋ ਕੈਰਮ ਬੋਰਡ ਅਤੇ ਚੈਸ ਵਗੈਰਾ ਖੇਡਦੇ ਹਨ ਅਤੇ ਅਤੇ ਥੋੜ੍ਹੇ ਬੱਚੇ ਥੋੜ੍ਹੇ ਥੋੜ੍ਹੇ ਵੱਡੇ ਹੁੰਦੇ ਫਿਰ ਉਹ ਪਕੜਮ ਪਕੜਾਈ ਅਤੇ ਊਚ ਨੀਚ ਵਗੈਰਾ ਊਚ ਨੀਚ ਤੇ ਪਾਪੜਾ ਅਤੇ ਇੱਦਾਂ ਦੀ ਕੁਛ ਗੇਮਾਂ ਖੇਡਦੇ ਹਨ ਅਤੇ ਜਦੋਂ ਉਹ ਜਦੋਂ ਸਕੂਲ ਵਗੈਰਾ 'ਚ ਜਾਂਦੇ ਹਨ ਅਤੇ ਜੋ ਉਹਨਾਂ ਦੀ ਏਜ ਟੀਨਏਜਰ ਏਜ ਵਿੱਚ ਵੀ ਆ ਜਾਂਦੇ ਹਨ ਅਤੇ ਉਹ ਫਿਰ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ 'ਤੇ ਵੈ ਕੀਤਾ ਨਹੀਂ ਹੁਣ ਜਾਂਦਾ ਇਸ ਸਮੇਂ ਵਿੱਚ ਕੋਈ ਕੁੜੀਆਂ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਹੁੰਦਾ ਅਤੇ ਜੋ ਹੁਣ ਜਿਵੇਂ ਕੁੜੀ ਮੁੰਡਿਆਂ ਦਾ ਕ੍ਰਿਕਟ ਮੁੰਡੇ ਖੇਡਦੇ ਆ ਅਤੇ ਕੁੜੀਆਂ ਵੀ ਕ੍ਰਿਕਟ ਖੇਡਦੀਆਂ ਹਨ ਅਤੇ ਆਈ ਪੀ ਐਲ ਵਗੈਰਾ ਵੀ ਜੇ ਮੁੰਡੇ ਖੇ ਮੁੰਡੇ ਕਰਦੇ ਹਨ ਅਤੇ ਕੁੜੀਆਂ ਵੀ ਉਹਨਾਂ ਵਿੱਚ ਭਾਗ ਲੈਂਦੀਆਂ ਹਨ ਅਤੇ ਅਤੇ ਹੋਰ ਵੀ ਜਿੱਦਾਂ ਪ੍ਰਕਾਰ ਦੀ ਖੇਡਾਂ ਹੁੰਦੀਆਂ ਹਨ ਬਾਸਕਟਬਾਲ ਬੈਡਮਿੰਟਨ ਕੁੜੀਆਂ ਮੁੰਡੇ ਦੋਨੇ ਹੀ ਖੇਡਦੇ ਹਨ ਅਤੇ ਉਹ ਹੋਰ ਤਰੀਕੇ ਦੇ ਵੀ ਗੇਮਾਂ ਬਾਸਕਿਟਬਾਲ ਬੈਡਮਿੰਟਨ ਅਤੇ ਫੁੱਟਬੋਲ ਕੁੜੀਆਂ ਮੁੰਡਿਆਂ ਵਿੱਚ ਅੱਜ ਕੱਲ੍ਹ ਕੋਈ ਫਰਕ ਨਹੀਂ ਹੁੰਦਾ ਅਤੇ ਉਹ ਕੁੜੀਆਂ ਮੁੰਡੇ ਦੋਨੇ ਹੀ ਇੱਦਾਂ ਦੀ ਗੇਮਾਂ ਵਿੱਚ ਖੇਡ ਸਕਦੇ ਹਨ